ਹੈਲੋ ਹਾਂਜੀ ਕੌਣ ਵੀਰ ਜੀ ਅੱਛਾ ਜੀ ਠੀਕ ਹੈ ਵੀਰ ਜੀ ਬੋਲੋ ਜੀ ਹਾਂਜੀ ਵੀਰ ਜੀ ਲੋਕਲ ਮਾਨਸਾ ਤੋਂ ਹੀ ਹਾਂ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਤੁਸੀਂ ਸੁਨਾਮ ਤੋਂ ਚੱਲਣਾ ਹੈ ਜੀ ਤੁਸੀਂ ਆਏਂ ਕਰਿਓ ਜੀ ਭਿੱਖੀ ਜਦੋਂ ਆਓਗੇ ਦਾਵਤ ਢਾਬਾ ਭਿੱਖੀ ਆਪਣੇ ਜੀ ਬਹੁਤ ਟੇਸਟੀ ਖਾਣਾ ਬਣਦਾ ਜੀ ਉੱਥੇ ਅਤੇ ਪ੍ਰਾਈਜ਼ ਬਹੁਤ ਹਾਂਜੀ ਹਾਂਜੀ ਬਹੁਤ ਫੈਸਿਲਿਟੀਆਂ ਨੇ ਜੀ ਅਤੇ ਰੇਟ ਵਗੈਰਾ ਬਹੁਤ ਘੱਟ ਨੇ ਜੀ ਉਹਨਾਂ ਦੇ ਰਹਿਣ ਲਈ ਰੂਮ ਵਗੈਰਾ ਹੈਗੇ ਨੇ ਜੀ ਉੱਥੇ ਹਾਂਜੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਖਿਆਲਾ ਆਉਂਦਾ ਜੀ ਆਪਣਾ ਖਿਆਲੇ ਵਧੀਆ ਸਿੱਧੂ ਢਾਬਾ ਹੈਗਾ ਜੀ ਅਤੇ ਬਹੁਤ ਵਧੀਆ ਬਹੁਤ ਵਧੀਆ ਜੀ ਰਹਿਣ ਸਹਿਣ ਦਾ ਬਹੁਤ ਵਧੀਆ ਜੀ ਰੂਮ ਵਗੈਰਾ ਸਾਰਾ ਕੁਛ ਜੀ ਇਸ ਤੋਂ ਬਾਅਦ ਤੁਸੀਂ ਮਾਨਸਾ ਆ ਜਾਓਗੇ ਜੀ ਮਾਨਸਾ ਬਰਾੜ ਸਵੀਟਸ ਨੇ ਜੀ ਬਹੁਤ ਫਰੈਸ਼ ਖਾਣਾ ਮਿਲਦਾ ਉਹਨਾਂ ਦਾ ਬਹੁਤ ਵਧੀਆ ਜੀ ਬਹੁਤ ਪਿਓਰ ਕੁਆਲਟੀ 'ਚ ਮਿਲਦਾ ਜੀ ਖਾਣਾ ਹਾਂਜੀ ਹਾਂਜੀ ਅਤੇ ਹੋਰ ਕਈ ਰੈਸਟੋਰੈਂਟ ਨੇ ਜੀ ਮਾਨਸਾ ਤੁਸੀਂ ਆਓ ਸਹੀ ਇੱਕ ਵਾਰ ਜੀ ਆ ਕੇ ਕੌਲ ਕਰ ਲਿਓ ਕੋਈ ਗੱਲ ਨਹੀਂ ਮੈਂ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜ਼ਰੂਰ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਓਕੇ ਜੀ